ਮੀਡੀਆ ਅਤੇ ਸਿੱਖਿਆ ਪ੍ਰਣਾਲੀ 'ਚ ਪੰਜਾਬੀ ਭਾਸ਼ਾ ਨੂੰ ਕਾਫੀ ਤਰਜੀਹ ਦਿੱਤੀ ਜਾਂਦੀ ਹੈ ਮੀਡੀਆ ਦੇ ਵਿੱਚ ਕਾਫੀ ਸਾਰੇ ਅਖਬਾਰ ਅਤੇ ਹੋਰ ਸ਼ੋਸ਼ਲ ਮੀਡੀਆ ਵਗੈਰਾ 'ਤੇ ਵੀ ਪੰਜਾਬੀ ਦਾ ਕਾਫੀ ਯੂਜ਼ ਹੋਣ ਲੱਗ ਗਿਆ ਹੈ ਪੰਜਾਬੀ ਭਾਸ਼ਾ ਨੂੰ ਕੋਲਜਾਂ ਅਤੇ ਸਕੂਲਾਂ ਦੇ ਵਿੱਚ ਵੀ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ ਜੇ ਤੁਸੀਂ ਪਲੱਸ ਟੂ ਤੱਕ ਪੰਜਾਬੀ ਨਹੀਂ ਪੜ੍ਹੀ ਹੈ ਤਾਂ ਤੁਸੀਂ ਅੱਗੋਂ ਕਿਸੇ ਵੀ ਨੌਕਰੀ ਦੇ ਲਈ ਐਲੀਜੀਬਲ ਨਹੀਂ ਓਂ ਬਾਹਰ ਤੋਂ ਵੀ ਕੋਈ ਦੂਸਰੇ ਸਟੇਟ ਤੋਂ ਕੋਈ ਪੰਜਾਬ ਦੇ ਵਿੱਚ ਨੌਕਰੀ ਲੈਣਾ ਚਾਹੁੰਦਾ ਤਾਂ ਉਸਨੂੰ ਵੀ ਪੰਜਾਬੀ ਦਾ ਪੇਪਰ ਲਾਜ਼ਮੀ ਵਿਸ਼ਾ ਕਰਕੇ ਪਾਸ ਕਰਨਾ ਜ਼ਰੂਰੀ ਹੈ ਬਾਕੀ ਪੰਜਾਬੀ ਭਾਸ਼ਾ ਨੂੰ ਆਮ ਤੌਰ 'ਤੇ ਪੰਜਾਬ ਦੇ ਲੋਕ ਤਾਂ ਜ਼ਿਆਦਾ ਪੜ੍ਹਨਾ ਅਤੇ ਸੁਣਨਾ ਪਸੰਦ ਕਰਦੇ ਹਨ ਇਸ ਦੇ ਵਿੱਚ ਅੱਗੇ ਨਾਲੋਂ ਕਾਫੀ ਸੁਧਾਰ ਆਇਆ ਏ ਯੂਥ ਫੈਸਟੀਵਲ ਵਗੈਰਾ ਵਿੱਚ ਵੀ ਪੰਜਾਬੀ ਦੇ ਉੱਤੇ ਕਾਫੀ ਜ਼ੋਰ ਦਿੱਤਾ ਗਿਆ ਹੈ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬੀ ਨੂੰ ਪੰਜਾਬੀ ਹੋਰ ਉੱਭਰ ਕੇ ਉੱਪਰ ਆਏਗੀ